ਪੰਜਾਬ ਵਿੱਚ ਗੇਮ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਗੇਮ ਡਿਵੈਲਪਮੈਂਟ ਨੂੰ ਲੈ ਕੇ ਮਤਲਬ ਅਖ਼ਬਾਰਾਂ ਟੈਲੀਵਿਜ਼ਨਾਂ ਆਦਿ ਮਤਲਬ ਬਹੁਤ ਜਗ੍ਹਾਵਾਂ 'ਤੇ ਲਬ ਇਲੈਕਟਰੋਨਿਕਸ ਦੇ ਖੇਤਰਾਂ ਵਿੱਚ ਵੀ ਗੇਮ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਜਿਵੇਂ ਓਲੰਪਿਕਸ ਕਹਿ ਸਕਦੇ ਹੋ ਅਤੇ ਆਮ ਪੇਂਡੂ ਖੇਤਰਾਂ ਵਿੱਚ ਵੀ ਗੇਮ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਸਰਕਾਰ ਵੱਲੋਂ ਮਤਲਬ ਜੋ ਕਿ ਇਹ ਹੁਣ ਦੀ ਸਰਕਾਰ ਆਪਣੇ ਸੀ ਐਮ ਸਾਹਿਬ ਭਗਵੰਤ ਮਾਨ ਜੀ ਵੱਲੋਂ ਵੀ ਗੇਮ ਖੇਤਰ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਜਾ ਰਿਹਾ ਜੋ ਕਿ ਜਿਵੇਂ ਕਿ ਸਰਕਾਰੀ ਸਕੂਲਾਂ ਵਿੱਚ ਗਰਾਊਂਡ ਬਣੇ ਜਾ ਰਹੇ ਹਨ ਅਤੇ ਹੋਰ ਹੋਰ ਵੀ ਮਤਲਬ ਲੜਕੀਆਂ ਦੇ ਕੱਦ ਵਧਾਉਣ ਲਈ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਗੇਮ ਬਹੁਤ ਜ਼ਰੂਰੀ ਹਨ ਅਤੇ ਆਪਣੇ ਪ੍ਰਧਾਨ ਮੰਤਰੀ ਜੀ ਇਸ ਵੱਲ ਅਤੇ ਸੀ ਐਮ ਜੀ ਇਸ ਵੱਲ ਬਹੁਤ ਹੀ ਜ਼ਿਆਦਾ ਯੋਗਦਾਨ ਪਾ ਰਹੇ ਹਨ ਅਤੇ ਇਸ ਨੂੰ ਨਿਵੇਸ਼ ਕਰਨ ਲਈ ਬਹੁਤ ਹੀ ਪ੍ਰੋਤਸਾਹਿਤ ਵੀ ਕਰ ਰਹੇ ਹਨ ਕਿ ਇਨ ਮਤਲਬ ਦੂਜਿਆਂ ਨੂੰ ਪ੍ਰੋਤਸਾਹਿਤ ਕਰ ਰਹੇ ਹਨ ਕਿ ਬੱਚੇ ਇਸ ਗੇਮ ਨੂੰ ਖੇਡ ਸਕਣ